ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਨੀ ਅਸੀਂ ਸੈਡ 'ਤੇ ਬਹਿ ਗੇ ਤੁਸੀਂ ਦੱਸੋ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ

ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਠੀਕ ਹੈ ਜੀ ਵਾਹ ਜੀ ਵਾਹ ਨਈਂ ਭਾਜੀ ਇਹ ਚਾਹੀਦਾ ਵੀ ਸੀਗਾ ਜੀ ਇਹ ਸਿਸਟਮ ਇਕੱਲਾ ਬੰਦਾ ਹੁਣ ਪੋਲਟਿਕਸ ਥੋੜ੍ਹੀ ਨਾ ਦੇਖ ਸਕਦਾ ਜੀ ਹਾਂਜੀ ਹਾਂਜੀ ਕੰਸੈਪਟ ਕਾਫ਼ੀ ਡਿਫਰੈਂਟ ਹੈ ਭਾਜੀ ਤੁਸੀਂ ਕੁਛ ਅਲੱਗ ਚੀਜ਼ ਸੋਚੀ ਹੈ ਹੁਣ ਅਸੀਂ ਦੇਖਦੇ ਹੈ ਇੱਕ ਵਾਰ ਇਹ ਪਰ ਅਸੀਂ ਮਿੱਥ ਕੇ ਕਰਦੇ ਹੈਂ ਗੱਲ ਇਸ ਉਪਰ ਨਾ ਹਾਂਜੀ ਹਾਂਜੀ ਤੁਸੀਂ ਵਧੀਆ ਚੀਜ ਲਿਖੀ ਵੈਸੇ ਕੋਈ ਮੈਂ ਕਹਿਨਾ ਇੰਡੀਆ 'ਚ ਹਜੇ ਤੱਕ ਇਹੋਹ ਜਿਹੀ ਬਣੀ ਨਹੀਂ ਹੈ ਮੂਵੀ ਤਾਂ ਕਰਕੇ ਤੁਸੀਂ ਹਾਂ ਵਧੀਆ ਚੀਜ ਦੇਖੀ ਹੈ ਹੋਰ ਭਾਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਕਿੰਨੇ ਟੈਮ ਦੀ ਮੂਵੀ ਹੋਊਗੀ ਭਾਜੀ ਠੀਕ ਹੈ ਜੀ ਠੀਕ ਹੈ ਗਾਣੇ ਗੂਣੇ ਵਿੱਚ ਪਾਉਣੇ ਪੈਣੇ ਨਾ ਫਿਰ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਇਹ ਤਾਂ ਹੈ ਜੀ ਫਿਰ ਆਪਾਂ ਆਪਾਂ ਨੂੰ ਭਾਜੀ ਐਕਟਰ ਵਧੀਆ ਚੁਣਨੇ ਪੈਣੇ ਇਸ ਵਾਸਤੇ ਫਿਰ ਹਾਂਜੀ ਹਾਂਜੀ

ਹਾਂਜੀ ਹਾਂਜੀ ਭਾਜੀ ਹਾਂਜੀ ਬਹੁਤ ਵੱਖਰੀ ਹੈ ਜੀ ਬਹੁਤ ਜ਼ਿਆਦਾ ਵੱਖਰੀ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ